ਹੈਲੋ ਹਾਂਜੀ ਕੀ ਹਾਲ ਚਾਲ ਹੈ ਹੋਰ ਸਭ ਠੀਕ ਠਾਕ ਹੈ ਹੋਰ ਲੱਗ ਗਿਆ ਦਿਲ ਦੁਲ ਬਸ ਹੁਣ ਆ ਜਾਣਾ ਜਲਦੀ ਆ ਜਾਣਾ ਬਸ ਆ ਜਾਣਾ ਜਲਦੀ ਆ ਜਾਣਾ ਹਾਂ ਹੋਰ ਓਹ ਠੀਕ ਹੈ ਓਹ ਸਾਹਮਣੇ ਜਿਹੜੇ ਗਵਾਂਢੀ ਉਹਨਾਂ ਦੇ ਕਪਲ 'ਚ ਬੜੇ ਇਸ਼ੂ ਚੱਲਣ ਦੇ ਹੀ ਅੱਜ ਕੱਲ੍ਹ ਵਾਕਿਆ ਹੀ ਕ ਕਪਿਲ ਸੰਸਥਾ 'ਚ ਨਾ ਬਹੁਤ ਜ਼ਿਆਦਾ ਇਸ਼ੂ ਚਲਦੇ ਹੈ ਹਾਂ ਕਪਲ 'ਚ ਬਹੁਤ ਜ਼ਿਆਦਾ ਇਸ਼ੂ ਚਲਦੇ ਹੈ ਨਾ ਦੋਨਾਂ 'ਚ ਆਪਸੀ ਸਪੋਰਟ ਨਹੀਂ ਹੈਗੀ ਜੇ ਕਿਤੇ ਦੁੱਖ ਆਉਂਦਾ ਤਾਂ ਦੂਜਾ ਉਹਦੀ ਹੈਲਪ ਨਹੀਂ ਕਰਦਾ ਜੇ ਘਰ 'ਚ ਮੰਨ ਲਓ ਕਿਸੇ ਨੇ ਕੁਛ ਕਹਿ ਦਿੱਤਾ ਦੂਜਾ ਗੱਲ ਬਰਦਾਸ਼ਤ ਨਹੀਂ ਕਰਦਾ ਠੀਕ ਹੈ ਨਾ ਦੋਨਾਂ 'ਚ ਆਪਸੀ ਸਪੋਰਟਡ ਹੋਏਗੀ ਤਾਂ ਇਸ਼ੂ ਕੋਈ ਵੀ ਨਹੀਂ ਆਏਗਾ ਦੋਨਾਂ 'ਚ ਪ੍ਰੇਮ ਪਿਆਰ ਵੀ ਹੋਏਗਾ ਜੇ ਇੱਕ 'ਤੇ ਦੁੱਖ ਦੀ ਘੜੀ ਆਈ ਹੈ ਤਾਂ ਦੂ ਦੂਜਾ ਹਮ ਦੂਜੀ ਸਪੋਰਟ ਕਰਨਾ ਚਾਹੀਦਾ ਹੈ ਦੋਨਾਂ 'ਚ ਆਪਸੀ ਪ੍ਰੇਮ ਪਿਆਰ ਹੋਣਾ ਚਾਹੀਦਾ ਹੈ ਚਲੋ ਠੀਕ ਹੈ ਮੈਂ ਨਾ ਥੋੜ੍ਹੀ ਦੇਰ ਬਾਅਦ ਕੋਲ ਕਰਾਂਗੀ ਠੀਕ ਹੈ ਓਕੇ